ਜੇ ਅਸੀਂ ਡਾਂਸ ਦੀ ਗੱਲ ਕਰੀਏ ਮੇਰੀ ਜ਼ਿੰਦਗੀ ਵਿੱਚ ਮੈਨੂੰ ਗਿੱਧਾ ਬਹੁਤ ਪਸੰਦ ਹੈ ਮੈਂ ਛੋਟੀ ਹੁੰਦੀ ਹੀ ਆਪਣੇ ਦੂਜੀ ਤੀਜੀ ਕਲਾਸ ਤੋਂ ਗਿੱਧੇ ਵਿੱਚ ਬਹੁਤ ਭਾਗ ਲੀਂਦੀ ਸੀ ਮੈਨੂੰ ਗਿੱਧਾ ਸਭ ਤੋਂ ਜ਼ਿਆਦਾ ਪਸੰਦ ਹੈ ਮੈਂ ਇੱਥੇ ਤੱਕ ਪਹੁੰਚੀ ਹਾਂ ਕਦੀ ਤੀਆਂ ਦਾ ਤਿਉਂਹਾਰ ਹੁੰਦਾ ਹੈ ਉੱਥੇ ਵੀ ਮੈਂ ਭਾਗ ਲੀਂਦੀ ਹਾਂ ਅਤੇ ਮੈਨੂੰ ਗਿੱਧਾ ਸਭ ਤੋਂ ਜ਼ਿਆਦਾ ਪਸੰਦ ਹੈ ਮੈਨੂੰ ਜ਼ਿੰਦਗੀ ਵਿੱਚ ਡਿਪਰੈਸ਼ਨ ਵੀ ਹੋਇਆ ਹੈ ਪਰ ਮੈਂ ਗਿੱਧੇ ਨਾਲ਼ ਬੜੀ ਖੁਸ਼ ਰਹਿੰਦੀ ਹਾਂ ਕਦੀ ਬੱਚਿਆਂ ਨੂੰ ਲੈ ਕੇ ਉਹਨਾਂ ਨੂੰ ਗਿੱਧਾ ਵੀ ਸਿਖਾਉਂਦੀ ਰਹਿੰਦੀ ਹਾਂ ਅਤੇ ਗਿੱਧਾ ਪਾਉਂਦੀ ਵੀ ਰਹਿੰਦੀ ਹਾਂ ਉਹਨਾਂ ਦੇ ਨਾਲ਼ ਮੇਰੇ ਮਨ ਨੂੰ ਬੜੀ ਅੱਛੀ ਤਰ੍ਹਾਂ ਚੈਨ ਮਿਲਦੀ ਹੈ ਅਤੇ ਖੁਸ਼ੀ ਮਿਲਦੀ ਹੈ ਅਤੇ ਗਿੱਧਾ ਪਾਉਣ ਨਾਲ਼ ਬਹੁਤ ਮਨ ਨੂੰ ਖੁਸ਼ੀ ਵੀ ਮਿਲਦੀ ਹਨ ਗਿੱਧਾ ਮੇਰੇ ਲਈ ਬਹੁਤ ਲਾਭਦਾਇਕ ਹੈ ਗਿੱਧਾ ਇੱਕ ਬਹੁਤ ਅੱਛੀ ਚੀਜ਼ ਹੈ ਮਨ ਨੂੰ ਮਨੋਰੰਜਨ ਵੀ ਮਿਲਦਾ ਹੈ ਅਤੇ ਆਪਣੇ ਸਰੀਰ ਨੂੰ ਤੰਦਰੁਸਤੀ ਵੀ ਮਿਲਦੀ ਹੈ